ਪੰਜਾਬ ਵਿੱਚ ਵਪਾਰਕ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ ਪੰਜਾਬ ਦੇ ਵਿੱਚ ਜ਼ਿਆਦਾਤਰ ਲੋਕ ਸਰਕਾਰੀ ਨੌਕਰੀ ਪਿੱਛੇ ਭੱਜਦੇ ਹਨ ਪਰ ਉਹਨਾਂ ਨੂੰ ਟ੍ਰੇਨਿੰਗ ਦੇ ਕੇ ਭਾਵੇਂ ਉਹ ਆਈ ਟੀ ਆਈ ਦੇ ਵਿੱਚ ਹੋਏ ਜਾਂ ਕਿਸੇ ਇੰਜਨੀਅਰਿੰਗ ਕੋਲਜ ਵਿੱਚ ਪੋਲੀਟੈਕਨਿਕ ਕੋਲਜਾਂ ਵਿੱਚ ਜਾ ਕੇ ਉਹਨਾਂ ਨੂੰ ਹੱਥੀਂ ਕੰਮ ਕਰਨ ਦੀ ਟ੍ਰੇਨਿੰਗ ਦਿੱਤੀ ਜਾਵੇ ਤਾਂ ਜੋ ਆਪਣੇ ਉਹ ਵਪਾਰਕ ਆਪਦਾ ਕੰਮ ਖੋਲ੍ਹ ਸਕਣ ਆਪਣਾ ਕੰਮ ਕਰ ਸਕਣ ਪੰਜਾਬ ਦੇ ਵਿੱਚ ਵਾਤਾਵਰਨ ਦੀ ਜਿਹੜੀ ਸਮੱਸਿਆ ਹੈਗੀ ਆ ਉਹ ਪ੍ਰਦੂਸ਼ਣ ਦੀ ਬਹੁਤ ਹੈ ਇਹਦੇ ਵਿੱਚ ਗੱਡੀਆਂ ਵਿੱਚੋਂ ਨਿਕਲਦਾ ਧੂੰਆਂ ਵਾਤਾਵਰਨ ਨੂੰ ਪਲਿਊਟ ਕਰਦਾ ਆ ਝੋਨੇ ਨੂੰ ਝੋਨੇ ਦੀ ਪਰਾਲੀ ਨੂੰ ਜਿਹੜੀ ਅੱਗ ਲਾਈ ਜਾਂਦੀ ਹੈ ਉਹਦੇ ਨਾਲ ਹੀ ਪ੍ਰਦੂਸ਼ਣ ਬਹੁਤ ਫੈਲਦਾ ਹੈ ਗੱਡੀਆਂ ਅਤੇ ਖੇਤੀਬਾੜੀ ਦੀ ਰਹਿੰਦ ਖੂੰਹਦ ਨੂੰ ਲਾਈ ਅੱਗ ਦੇ ਨਾਲ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਹੋਰ ਖੇਤਰ ਹੋਰ ਸਟੇਟਾਂ ਜਿਹੜੀਆਂ ਹੈਗੀਆਂ ਹਰਿਆਣਾ ਦਿੱਲੀ ਰਾਜਸਥਾਨ ਜੰਮੂ ਤੱਕ ਇਹਦਾ ਧੂੰਆਂ ਜਾਂਦਾ ਜਿਹੜਾ ਨਾਲ ਦੇ ਰਾਜਾਂ ਨੂੰ ਵੀ ਪ੍ਰਦੂਸ਼ਿਤ ਕਰਦਾ ਹੈ ਇਹ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਰਕਾਰ ਨੂੰ ਕਿਸਾਨਾਂ ਨੂੰ ਸਿਖਲਾਈ ਦੇਣੀ ਚਾਹੀਦੀ ਆ ਉਹਨੂੰ ਨਵੀਂ ਟੈਕਨੋਲੋਜੀ ਦੀਆਂ ਮਸ਼ੀਨਾਂ ਦੇਣੀਆਂ ਚਾਹੀਦੀਆਂ ਤਾਂ ਜੋ ਆਪਣੀ ਉਹ ਪਰਾਲੀ ਨੂੰ ਖੇਤਾਂ ਵਿੱਚ ਹੀ ਪ੍ਰਯੋਗ ਕਰ ਸਕਣ ਪਰਾਲੀ ਤੋਂ ਖਾਦ ਬਣਾ ਕੇ ਆਪਦੇ ਖੇਤਾਂ ਦੀ ਜਿਹੜੀ ਸਿਹਤ ਨੂੰ ਠੀਕ ਰੱਖ ਸਕਣ ਕਿਉਂਕਿ ਪਰਾਲੀ ਨੂੰ ਅੱਗ ਲਾਉਣ ਨਾਲ ਜਿਹੜੇ ਉਹਨਾਂ ਵਿੱਚ ਜੀਵ ਪੈਦਾ ਹੁੰਦੇ ਆ ਜਿਹੜੇ ਕਿਸਾਨਾਂ ਦੇ ਮਿੱਤਰ ਜੀਵ ਹੈਗੇ ਆ ਗੰਡੋਏ ਹੈਗੇ ਆ ਉਹ ਸੜ ਜਾਂਦੇ ਆ ਮੱਚ ਜਾਂਦੇ ਆ ਜਿਹੜੀ ਫਰੀ ਵਿੱਚ ਕਿਸਾਨਾਂ ਨੂੰ ਖਾਦ ਮਿਲਣੀ ਹੁੰਦੀ ਜਿਹੜੀ ਗੰਡੋਇਆਂ ਵੱਲੋਂ ਜਾਂ ਹੋਰ ਜੀਵ ਜੰਤੂ ਵੱਲੋਂ ਬਣਾਈ ਜਾਂਦੀ ਆ ਉਹ ਸਾਰੀ ਵੇਸਟ ਹੋ ਜਾਂਦੀ ਆ ਅਤੇ ਵਾਤਾਵਰਨ ਤਾਂ ਹੀ ਬਚ ਸਕਦਾ ਹੈ ਜੇ ਕਿਸਾਨ ਵੀ ਇਹਦੇ ਬਾਰੇ ਅਵੇਅਰ ਹੋਣਗੇ ਸਰਕਾਰ ਵੀ ਕਿਸਾਨਾਂ ਦੀ ਮਦਦ ਕਰੇ ਕਿਉਂਕਿ ਇਸ ਕੰਮ ਨੂੰ ਕਰਨ ਲਈ ਪੈਸੇ ਦੀ ਜ਼ਰੂਰਤ ਪੈਂਦੀ ਹੈ ਜੋ ਸਰਕਾਰ ਹੀ ਉਹਨਾਂ ਦੀ ਮਦਦ ਕਰ ਸਕਦੀ ਹੈ